ਟੈਕਨੋਲਜੀ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਆ ਕਿਉਂਕਿ ਪਿਛਲੇ ਸਾਲਾਂ ਵਿੱਚ ਕਰੋਨਾ ਵਾਇਰਸ ਨੇ ਇੰਨਾ ਭਿਆਨਕ ਦੌਰ ਚੱਲ ਰਿਹਾ ਸੀ ਕਿ ਲੋਕਾਂ ਨੇ ਆਪਣਾ ਘਰ ਬਾਰ ਛੱਡਿਆ ਨਹੀਂ ਉਹਨਾਂ ਨੇ ਬੱਚੇ ਸਕੂਲ ਨਹੀਂ ਜਾਂਦੇ ਸਨ ਕਿਉਂਕਿ ਜੇ ਉਹ ਸਕੂਲ ਜਾਂਦੇ ਤਾਂ ਉਹਨਾਂ ਨੂੰ ਇਹ ਬਿਮਾਰੀ ਹੋਣ ਦਾ ਡਰ ਸੀਗਾ ਇਸ ਲਈ ਬੱਚਿਆਂ ਨੇ ਆਪਣੇ ਪੇਪਰ ਇਗਜ਼ਾਮ ਪੜ੍ਹਾਈ ਆਨਲਾਈਨ ਕਲਾਸਾਂ ਰਾਹੀਂ ਹੀ ਜਾਰੀ ਰੱਖੀ ਸੀਗੀ ਯੂਟਿਊਬ 'ਤੇ ਸਿੱਖਦੇ ਸੀ ਅਤੇ ਆਪਣੇ ਪੇਪਰ ਦਿੰਦੇ ਸੀ ਆਨਲਾਈਨ ਕੋਰਸ ਕਰਦੇ ਸੀਗੇ ਅਤੇ ਆਪਣੀ ਐਡਮਿਸ਼ਨਾਂ ਵੀ ਆਨਲਾਈਨ ਹੀ ਕਰਵਾਉਂਦੇ ਸੀਗੇ ਹੁਣ ਵੀ ਉਸ ਦੌਰ ਤੋਂ ਬਾਅਦ ਜਿਹੜੇ ਆਪਣੇ ਪੜ੍ਹਾਈ ਪੂਰੀ ਨਹੀਂ ਕਰ ਸਕੇ ਉਸ ਸਮੇਂ ਵਿੱਚ ਹੁਣ ਉਹ ਆਨਲਾਈਨ ਬੈਠ ਕੇ ਘਰ ਬੈਠ ਕੇ ਹੀ ਕੰਮਕਾਰ ਸਿੱਖਦੇ ਨੇ ਅਤੇ ਆਨਲਾਈਨ ਪੇਪਰ ਦਿੰਦੇ ਨੇ ਆਨਲਾਈਨ ਐਡਮਿਸ਼ਨਾਂ ਕਰਵਾਉਂਦੇ ਨੇ ਇਸ ਲਈ ਟੈਕਨੋਲਜੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਕੁਝ ਵੀ ਹੋ ਸਕ ਕਰ ਸਕਦੇ ਹਾਂ ਘਰ ਬੈਠ ਕੇ ਆਪਣਾ ਬਿਜ਼ਨਸ ਵੀ ਸਟਾਰਟ ਕਰ ਸਕਦੇ ਹਾਂ ਟੈਕਨੋਲੋਜੀ ਬਹੁਤ ਵਧੀਆ ਚੀਜ਼ ਹੈ